ਹੈਲੋ ਹਾਂਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਇਸ਼ਪ੍ਰੀਤ ਬੋਲ ਰਹੀ ਹਾਂ ਮੈਨੂੰ ਤੁਹਾਡੀ ਕੰਪਨੀ ਦਾ ਨੰਬਰ ਦਿੱਤਾ ਸੀਗਾ ਕਿਸੇ ਮੇਰੀ ਫਰੈਂਡ ਨੇ ਵੀ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਕਰਦੇ ਹੋ ਤੁਸੀਂ ਮੈਮ ਤੁਸੀਂ ਦੱਸ ਸਕਦੇ ਹੋ ਜੀ ਕੀ ਕੀ ਸਰਵਿਸਿਸ ਤੁਸੀਂ ਦਿੰਦੇ ਹੋ ਅੱਛਾ ਜੀ ਮੈਮ ਅਸਲ ਦੇ ਵਿੱਚ ਨਾ ਮੈਂ ਡਰਾਇੰਗ ਰੂਮ ਦੇ ਵਿੱਚ ਅਤੇ ਆਪਣਾ ਜਿਹੜਾ ਲੋਬੀ ਲਿਵਿੰਗ ਏਰੀਆ ਆਪਣਾ ਹੁੰਦਾ ਉਹਦੇ 'ਚ ਐਲਈਡੀ ਪੈਨਲ ਲ ਲੱਕੜ ਦਾ ਕੰਮ ਕਰਾਉਣਾ ਚਾਹੁੰਦੀ ਸੀ ਥੋੜ੍ਹਾ ਜਿਹਾ ਅਤੇ ਕਪਬਰਡ ਜਿਹੜੀਆਂ ਆਪਣੀਆਂ ਹੈਗੀਆਂ ਮੇਰੀਆਂ ਬਣੀਆਂ ਹੋਈਆਂ ਪੁਰਾਣੀਆਂ ਪਹਿਲਾਂ ਉਹਨਾਂ ਨੂੰ ਥੋੜ੍ਹੀ ਜਿਹੀ ਨਵੀਂ ਲੁੱਕ ਦੇਣੀ ਚਾਹੁੰਦੀ ਸੀ ਅਤੇ ਫਾਲਸੀਲਿੰਗ ਦਾ ਮੈਨੂੰ ਸੀਗਾ ਵੀ ਤੁਸੀਂ ਜੇ ਕੰਮ ਕਰ ਸਕਦੇ ਹੋ ਮੈਨੂੰ ਚਾਰਜਿਸ ਵਗੈਰਾ ਥੋੜ੍ਹੇ ਜਿਹੇ ਆਈਡੀਆ ਦੇ ਦਿਉ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਜਿਹੜਾ ਸਮਾਨ ਹੋਊਗਾ ਜੀ ਉਹ ਫਿਰ ਸਾਡਾ ਹੋਏਗਾ ਜਾਂ ਤੁਹਾਡੀ ਕੰਪਨੀ ਪ੍ਰੋਵਾਈਡ ਕਰਦੀ ਹੈ ਠੀਕ ਹੈ ਠੀਕ ਹੈ ਮੈਮ ਠੀਕ ਹੈ ਜੀ ਅਤੇ ਇਹਦੇ ਲਈ ਫਿਰ ਤੁਸੀਂ ਆਪਣਾ ਤੁਹਾਨੂੰ ਵਿਜ਼ਿਟ ਕਰ ਸਕਦੇ ਹਾਂ ਕਿਸੇ ਟਾਈਮ ਤੁਸੀਂ ਅਵੇਲੇਬਲ ਹੁੰਦੇ ਹੋ ਔਫਿਸ ਦੇ ਵਿੱਚ ਜਾਂ ਕਿਵੇਂ ਤੁਸੀਂ ਫਿਰ ਪਰਸਨਲੀ ਆ ਕੇ ਆਪਣਾ ਕੰਮ ਸਾਰਾ ਕਰਵਾਉਂਦੇ ਹੋ ਇੱਥੇ ਆ ਕੇ ਤੁਹਾਡਾ ਬੰਦਾ ਆਉਂਦਾ ਕੋਈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੱਛਾ ਕਦੋਂ ਮਿਲ ਸਕਦੇ ਹੋ ਜੀ ਕਦੋਂ ਮੈਂ ਮਿਲ ਸਕਦੀ ਹਾਂ ਤੁਹਾਨੂੰ ਅੱਛਾ ਕੱਲ ਚੱਲੋ ਮੈਂ ਗਿਆਰਾਂ ਕੁ ਵਜੇ ਕੋਸ਼ਿਸ਼ ਕਰਦੀ ਹਾਂ ਹੈ ਨਾ ਮਿਲਦੇ ਹਾਂ ਫਿਰ ਆਪਾਂ ਹਾਂ ਠੀ ਠੀਕ ਹੈ ਮੈਮ ਠੀਕ ਹੈ ਜੀ ਓਕੇ ਧੰਨਵਾਦ ਜੀ ਓਕੇ